ਸਤਿ ਸ਼੍ਰੀ ਅਕਾਲ ਜੀ ਹਾਂਜੀ ਸ਼ਰਮਾ ਟਰੈਵਲ ਤੋਂ ਬੋਲਦੇ ਹਾਂ ਜੀ

ਠੀਕ ਹੈ ਜੀ ਠੀਕ ਹੈ ਦੇਖੋ ਜੀ ਬੱਸ 'ਤੇ ਤਾਂ ਅੱਜ ਕੱਲ੍ਹ ਬਹੁਤ ਰੱਛ ਹੁੰਦਾ ਜੀ ਤਾਂ ਗੱਡੀ 'ਤੇ ਹੀ ਠੀਕ ਰਹੂਗਾ

ਗੱਡੀ ਤੁਹਾਡੇ ਵਾਸਤੇ ਦੇਖ ਕੇ ਭੇਜ ਦਾਂਗੇ ਜੀ ਅਤੇ ਕਿਰਾਇਆ ਇੱਕ ਵਾਰ ਆਉਣ ਜਾਣ ਦਾ ਤੁਹਾਡਾ ਛੇ ਕੁ ਹਜ਼ਾਰ ਰੁਪਇਆ ਪੈ ਜੂਗਾ ਜੀ ਨਹੀਂ ਸਾਰਿਆਂ ਦਾ ਇਕੱਠਾ ਹੀ ਪੈਜੂਗਾ ਜੀ ਚਾਰ ਜਣਿਆਂ ਦਾ ਹਾਂ ਜੀ ਹਾਂਜੀ ਹਾਂ ਜੀ ਹਾਂਜੀ ਨਹੀਂ ਇਹ ਤਾਂ ਜੀ ਜੁੜ ਕੇ ਹੀ ਹੁੰਦਾ ਜੀ ਸਾਰਾ ਹਾਂ ਜੀ ਹਾਂ ਜੀ ਟੋਲ ਟੈਕਸ ਲਾ ਕੇ ਨਹੀਂ ਸਾਰਾ ਕੁਛ ਮਿਕ ਲਾ ਕੇ ਹੀ ਦਿੰਦੇ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਅਤੇ ਜੇ ਰਹਿਣਾ ਤੁਸੀਂ ਉਹਦਾ ਵੀ ਦੱਸਦੇ ਜੀ ਹਜ਼ਾਰ ਰੁਪਇਆ ਪਰ ਹੈਗਾ ਹੈ ਨਹੀਂ ਦੋ ਦੋ ਜਣਿਆ ਦਾ ਹੋ ਸਕਦਾ ਜੀ ਉਹਦੇ 'ਚ ਕੋਈ ਗੱਲ ਨਹੀਂ ਜੀ ਉਹ ਦੇਖ ਲਾਂਗੇ ਜੀ ਫਿਰ ਜੇ ਤੁਸੀਂ ਰਹਿ ਲਉਂਗੇ ਰਹੋਂਗੇ ਤਾਂ ਫਿਰ ਤੁਹਾਨੂੰ ਹੋਰ ਜਗ੍ਹਾ ਵੀ ਘੁੰਮਾ ਦਾਂਗੇ ਹਾਂਜੀ ਉਹ ਮੌਕੇ 'ਤੇ ਦੇਖ ਲਾਂਗੇ ਠੀਕ ਹੈ ਸਰ ਠੀਕ ਹੈ ਸਰ ਓਕੇ ਬਾਏ ਠੀਕ